ਕਰੀਮ ਲਈ ਮੈਂ ਉਹ ਬੜੀ ਬਹੁਤ ਬੇਕਾਰ ਨਿਕਲੀ ਹੈ ਐਂ ਸਾਰੇ ਮੂੰਹ 'ਤੇ ਦਾਣੇ ਨਿਕਲ ਆਏ ਨੇ ਕਿ ਜਿਸ ਜਿਸ ਨੇ ਵਰਤੀ ਹੈ ਉਹੀ ਉਹੀ ਬੋਲੇ ਕਰਦਾ ਕੀ ਕਰ ਸਕਦੇ ਅਸੀਂ ਬਤਾਓ ਕਿੰਨੀ ਬੇਕਾਰ ਕੁਆਲਟੀ ਆ ਹਾਂਜੀ ਤੁਹਾਡੇ ਕੋਲੋਂ ਮੰਗਵਾਈ ਸੀ ਅਤੇ ਬਸ ਆਹੋ ਖ਼ਰਾਬ ਨਿਕਲੀ ਹੈ ਉਹ ਹਾਂਜੀ ਹਾਂ ਅੱਗੇ ਅੱਗੇ ਤੋਂ ਹੋ ਗਿਆ ਕਿ ਹੁਣ ਕਦੀ ਨਹੀਂ ਚੀਜ਼ ਲਊਂਗੇ ਤੁਹਾਡੇ ਕੋਲੋਂ ਅਸੀਂ ਜੀ ਮੇਰੇ ਪੈਸੇ ਵਾਪਸ ਕਰਨੇ ਤਾਂ ਬਤਾ ਦਿਓ ਤੇ ਨਹੀਂ ਤਾਂ ਤੁਹਾਡੀ ਮਰਜ਼ੀ ਸਾਨੂੰ ਆਪਣੇ ਪੈਸੇ ਵਾਪਸ ਚਾਹੀਦੇ ਨੇ ਆਪਣਾ ਪਜੋ ਪ੍ਰੋਜੈਕਟ ਲੈ ਜਾਉ ਹਾਂਜੀ ਸਾਨੂੰ ਚੰਗਾ ਨਹੀਂ ਲੱਗਾ ਠੀਕ ਹੈ